ਸਤ ਸ਼ੀ ਸਤਿ ਸ਼੍ਰੀ ਅਕਾਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਭੰ ਅੱਜ ਮੈਂ ਜਿਵੇਂ ਕਿ ਦੱਸਾਂ ਕਿ ਭੰਗੜੇ ਦੇ ਭੰਗੜੇ ਦੇ ਕੁਝ ਆਮ ਸਟੈਪ ਕੀ ਹਨ ਜਿਵੇਂ ਕਿ ਆਮ ਸਟੈਪ ਬਾਹਾਂ ਨੂੰ ਉੱਤੇ ਕਰਕੇ ਜਿਹੜਾ ਡਾਂਸ ਕਰਦੇ ਹੈਗੇ ਆ ਅਤੇ ਡਾਂਸ ਕਰਨਾ ਅਤੇ ਉੱਠਕ ਬੈਠਕ ਕਰਨੀ ਅਤੇ ਹੋਰ ਵੀ ਹੋਰ ਵੀ ਜਿਹੜੇ ਡਾਂਸ ਕਰਦੇ ਆ ਧੰਨਵਾਦ